ਹਾਂਜੀ ਸਾਡੇ ਨੇੜੇ ਕਈ ਕਰਿਆਨੇ ਦੀਆਂ ਦੁਕਾਨਾਂ ਨੇ ਸਾਡਾ ਪਿੰਡ ਇੱਕ ਕਸਬੇ ਦੇ ਰੂਪ 'ਚ ਬਣਿਆ ਹੋਇਆ ਹੈ ਜਿਸ ਕਰਕੇ ਸਾਨੂੰ ਇੱਥੇ ਹਰ ਸਹੂਲਤ ਮਿਲਦੀ ਹੈ ਸਾਨੂੰ ਸਮਾਨ ਦੀ ਖਰੀਦਦਾਰੀ ਲਈ ਸ਼ਹਿਰ ਨਹੀਂ ਜਾਣਾ ਪੈਂਦਾ ਅਤੇ ਮੀਂਹ ਹਨੇਰੀ 'ਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਇਹਨਾਂ ਕਰਿਆਨੇ ਦੀਆਂ ਦੁਕਾਨਾਂ 'ਤੇ ਸਾਨੂੰ ਹਰ ਕਿਸਮ ਦਾ ਸਮਾਨ ਮਿਲਦਾ ਹੈ ਜਿੱਦਾਂ ਕਿ ਸਾਬਣ ਸੋਡਾ ਖਾਣ ਦਾ ਸਮਾਨ ਆਟਾ ਘਿਓ ਚੀਨੀ ਪੱਤੀ ਹਰ ਤਰ੍ਹਾਂ ਦੀਆਂ ਦਾਲਾਂ ਗੁੜ ਸ਼ੱਕਰ ਇਥੋਂ ਤੱਕ ਕਿ ਬੱਚਿਆਂ ਦੇ ਖਾਣ ਪੀਣ ਦਾ ਸਮਾਨ ਵੀ ਵਧੀਆ ਅਤੇ ਸਸਤੇ ਰੇਟਾਂ 'ਤੇ ਮਿਲ ਜਾਂਦਾ ਹੈ ਅਤੇ ਇਹਨਾਂ ਦੀ ਕਿਸਮਾਂ ਵੀ ਬੜੀ ਵਧੀਆ ਹੁੰਦੀਆਂ ਹਨ ਅਤੇ ਜਦੋਂ ਕੋਈ ਅਚਨਚੇਤ ਪ੍ਰਾਹੁਣਾ ਘਰ ਆ ਜਾਵੇ ਤਾਂ ਸਾਨੂੰ ਸ਼ਹਿਰੋ ਸਮਾਨ ਲੈ ਕੇ ਆਉਣ ਦੀ ਲੋੜ ਨਹੀਂ ਪੈਂਦੀ ਸਗੋਂ ਅਸੀਂ ਆਪਣੇ ਘਰ ਨੇੜਲੇ ਕਰਿਆਨੇ ਦੀਆਂ ਦੁਕਾਨਾਂ ਤੋਂ ਹੀ ਸਮਾਨ ਖਰੀਦ ਲੈਂਦੇ ਹਾਂ ਅਸੀਂ ਸੌਦੇਬਾਜ਼ੀ ਦਾ ਭੁਗਤਾਨ ਵੀ ਉਸ ਸਮੇਂ ਕਰ ਦਿੰਦੇ ਹਾਂ ਜਦੋਂ ਅਸੀਂ ਕੋਈ ਵੀ ਸੌਦਾ ਉਹਨਾਂ ਦੀ ਦੁਕਾਨ ਤੋਂ ਲੈਂਦੇ ਹਾਂ